ਹੈਲੋ ਹਾਂਜੀ ਜਸ਼ਨਦੀਪ ਕੀ ਹਾਲ ਚਾਲ ਬਸ ਵਧੀਆ ਕੋਲੇਜ ਜਾ ਰਹੇ ਜਾਂ ਹੁਣ ਕਿ ਨਹੀਂ ਠੰਡ ਬਹੁਤ ਵੱਧਦੀ ਜਾ ਰਹੀ ਆ ਇਹਨਾਂ ਨੂੰ ਛੁੱਟੀਆਂ ਕਰਨੀਆਂ ਚਾਹੀਦੀਆਂ ਥੋੜ੍ਹੀਆਂ ਜਿਹੀਆਂ ਹੋਰ ਮੈਂ ਅੱਜ ਕੋਲੇਜ ਗਿਆ ਹੀ ਅੱਜ ਇੱਕ ਮੈਡਮ ਪੜ੍ਹਾਉਂਦੀ ਕੋਲੇਜ ਦੇ ਵਿੱਚ ਜਦੋਂ ਉਹ ਪੜ੍ਹਾਉਂਦੀ ਅਤੇ ਉਹ ਕੰਬੀ ਜਾਵੇ ਮੈਂ ਕਿਹਾ ਇਸ ਤਰ੍ਹਾਂ ਕਿਸੇ ਦੀ ਸਿਹਤ ਵੀ ਖ਼ਰਾਬ ਹੋ ਸਕਦੀ ਨਾਲੇ ਬੱਚੇ ਤੁਹਾਨੂੰ ਪਤਾ ਛੋਟੇ ਵੀ ਪੜ੍ਹਦੇ ਮੈਂ ਤਾਂ ਅੱਜ ਇਹਨਾਂ ਨੂੰ ਐਪਲੀਕੇਸ਼ਨ ਲਿਖ ਕੇ ਪਾਈ ਆ ਕਿ ਘੱਟੋ ਘੱਟ ਇੱਕ ਘੰਟਾ ਤਾਂ ਲੇਟ ਕਰੋ ਛੁੱਟੀਆਂ ਨਹੀਂ ਕਰਨੀਆਂ ਤਾਂ ਘੱਟੋ ਘੱਟ ਦਸ ਵਜੇ ਦਾ ਟਾਈਮ ਰੱਖੋ ਇਹ ਤਾਂ ਨੌ ਵਜੇ ਲੈਕਚਰ ਲਾਉਣੇ ਸ਼ੁਰੂ ਕਰ ਦਿੰਦੇ ਬੱਚਾ ਘਰੋਂ ਸਾਢੇ ਅੱਠ ਜਾਂਦਾ ਆ ਅਤੇ ਇਸ ਤਰ੍ਹਾਂ ਫਿਰ ਆਪਾਂ ਲੇਟ ਪਹੁੰਚਦੇ ਹਾਂ ਧੁੰਦ ਬਹੁਤ ਜ਼ਿਆਦੇ ਪੈ ਰਹੀ ਇਸ ਕਰਕੇ ਇਹਨਾਂ ਨੂੰ ਇਹੋ ਜਿਹੇ ਕੋਈ ਸਟੈਪ ਲੈਣੇ ਚਾਹੀਦੇ ਜਿਹਦੇ ਨਾਲ ਬੱਚੇ ਸੇਫਲੀ ਕੋਲੇਜ ਜਾ ਸਕਣ ਅਤੇ ਆਰਾਮ ਨਾਲ ਪੜ੍ਹ ਸਕਣ ਚਲੋ ਕੋਈ ਨਹੀਂ ਤੁਸੀਂ ਆਓ ਕੱਲ੍ਹ ਕੋਲੇਜ ਅਤੇ ਆਪਾਂ ਗੱਲ ਕਰਦੇ ਹਾਂ ਦੋਨੋਂ ਜਣੇ ਰਲ ਕੇ ਪ੍ਰਿੰਸੀਪਲ ਨਾਲ